ਸਾਡੇ ਪਿੰਡ ਦੀ ਸਥਾਨਕ ਖੁਰਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਕਿ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਹਨ ਗੁਰਦੁਆਰਾ ਸਾਹਿਬ ਵਿੱਚ ਸਾਰੇ ਹੀ ਰੀਤੀ ਰਿਵਾਜ ਜੋ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਏ ਗਏ ਹਨ ਉਹ ਕੀਤੇ ਜਾਂਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ 'ਤੇ ਪ੍ਰਕਾਸ਼ ਕੀਤੇ ਜਾਂਦੇ ਹਨ ਅਤੇ ਸਾਰੇ ਪਿੰਡ ਦੀ ਸੰਗਤ ਉੱਥੇ ਨਤਮਸਤਕ ਹੁੰਦੀ ਹੈ ਅਤੇ ਆਪਣਾ ਮਨੋਕਾਮਨਾ ਮੰਗਦੀ ਹੈ ਅਤੇ ਸਾਰਿਆਂ ਦੀ ਮਨੋਕਾਮਨਾ ਉੱਥੇ ਪੂਰੀ ਹੁੰਦੀ ਹੈ